ਭੰਗੜੇ ਦੀ ਐਰੋਬਿਕਸ ਬਣਾਉਣ ਲਈ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇੱਕ ਉਤਸ਼ਾਹ ਭਰਿਆ ਪੰਜਾਬੀ ਨ੍ਰਿਤ ਹੈ ਜੋ ਸ਼ਕਤੀ ਥਾਪ ਅਤੇ ਸਰੀਰ ਨੂੰ ਫੁਰਤੀ ਨੂੰ ਵਧਾਉਂਦਾ ਹੈ ਜਦੋਂ ਭੰਗੜੇ ਨੂੰ ਐਰੋਬਿਕ ਨਾਲ ਜੋੜ ਕੇ ਤਿਆਰ ਕੀਤਾ ਜਾਂਦਾ ਹੈ ਤਾਂ ਇੱਕ ਉੱਚਿਤ ਤਿ ਤਿਰੰਗ ਵਾਲੀ ਆਡੀਓ ਵਿਆਕਰਨ ਬਣ ਜਾਂਦੀ ਹੈ ਜੋ ਨਾ ਸਿਰ ਨੂੰ ਮਨੋਰੰਜਕ ਹੁੰਦੀ ਹੈ ਸਗੋਂ ਸਰੀਰਕ ਤੰਦਰੁਸਤੀ ਲਈ ਵੀ ਬਹੁਤ ਲਾਭਕਾਰੀ ਹੈ ਭੰਗੜੇ ਦੀ ਐਰੋਬਿਕ ਬਣਾਉਣ ਲਈ ਪਹਿਲਾਂ ਅਸੀਂ ਭੰਗੜੇ ਦੇ ਆਧੁਨਿਕ ਅਤੇ ਰਵਾਇਤੀ ਗਤੀਵਿਧੀਆਂ ਸਮਝਦੇ ਹਾਂ ਅਤੇ ਉਨ੍ਹਾਂ ਨੂੰ ਵਿਗਿਆਨਿਕ ਤਰੀਕੇ ਨਾਲ ਐਕਸਾਈਜ਼ ਵਿੱਚ ਸ਼ਾਮਿਲ ਕਰਦੇ ਹਾਂ ਭੰਗੜੇ ਦੀ ਅਸੀਂ ਇਸ ਤਰ੍ਹਾਂ ਰਚਨਾ ਕਰਦੇ ਹਾਂ ਵਮ ਪਹਿਲਾਂ ਅਸੀਂ ਭੰਗੜੇ ਕੋਈ ਵੀ ਐਕਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਸ਼ਰੀਰ ਨੂੰ ਗਰਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਭੰਗੜੇ ਨੂੰ ਐਰੋਬਿਕਸ ਵਿੱਚ ਹੌਲੀ ਹੌਲੀ ਹਿੱਲਣ ਡੁੱਲਣ ਬੇਸਿਕ ਟੱਪੇ ਅਤੇ ਹੱਥਾਂ ਦੀ ਮੁਮੈਂਟ ਕਰਕੇ ਮਾਸਪੇਸ਼ੀਆਂ ਨੂੰ ਗਰਮ ਕਰਦੇ ਹਾਂ ਦੂਸਰਾ ਹੁੰਦਾ ਹੈ ਮੁੱਖ ਭਾਗ ਇਹ ਭਾਗ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ ਇਸ ਵਿੱਚ ਅਸੀਂ ਭੰਗੜੇ ਦੇ ਵੱਖ ਵੱਖ ਮੂਲ ਸਟੈਪਸ ਨੂੰ ਸ਼ਾਮਿਲ ਕਰਦੇ ਹਾਂ ਜਿਵੇਂ ਕਿ ਧਮਾਲ ਚਮਾਰ ਫਿਰਕੀ ਧੁੱਮਾ ਸਿੱਧਾ ਪਾਰਸਾ ਆਦਿ ਇਨ੍ਹਾਂ ਸਟੈਂਸ ਨੂੰ ਤੇਜ਼ ਗਤੀ ਨਾਲ ਸਰੀਰ ਦੀ ਸਟੈਮੀਨਰੀ ਵੱਧਦੀ ਹੈ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਲ ਦੀ ਗਤੀ ਤਰੋ ਤਾਜ਼ਾ ਰਹਿੰਦੀ ਹੈ ਹਾਈ ਇੰਸਿਟੀ ਭਾਗ ਤੀਸਰਾ ਇਹ ਭਾਗ ਸਭ ਤੋਂ ਜ਼ਿਆਦਾ ਕੈਲਰੀ ਸਾੜਨ ਵਿੱਚ ਮਦਦ ਕਰਦਾ ਹੈ ਇਸ ਵਿੱਚ ਅਸੀਂ ਡਬਲ ਜੰਪ ਕਿੱਕ ਜੰਪ ਤੇਜ਼ ਧਮਾਕੇਦਾਰ ਮੁਮੈਂਟ ਅਤੇ ਸਰੀਰ ਦੇ ਵੱਖ ਵੱਖ ਭਾਗਾਂ ਨੂੰ ਵਰਤਣ ਵਾਲੀ ਐਕਸਾਈਜ਼ ਨੂੰ ਸ਼ਾਮਿਲ ਕਰਦੇ ਹਾਂ ਕੂਲਡਾਨ ਵਧੇਰੇ ਉਤਸ਼ਾਹ ਤੋਂ ਬਾਅਦ ਸਰੀਰ ਨੂੰ ਹੌਲੀ ਹੌਲੀ ਅਰਾਮ ਦਵਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਇਸ ਵਿੱਚ ਅਸੀਂ ਹੌਲੀ ਹੌਲੀ ਹਿੱਲਣ ਡੁੱਲਣ ਹੱਥਾਂ ਅਤੇ ਲੱਤਾਂ ਦੀ ਸਟ੍ਰੈਚਿੰਗ ਸ਼ਾਂਤ ਪੂਰਨ ਸੰਗੀਤ ਨਾਲ ਹਲਕੇ ਭੰਗੜੇ ਦੇ ਸਟੈਪ ਕਰਕੇ ਮਾਸਪੇਸ਼ੀਆਂ ਨੂੰ ਢਿੱਲਾ ਕਰਦੇ ਹਾਂ ਇਸ ਦੇ ਲਾਭ ਵੀ ਬਹੁਤ ਹਨ ਲਾਭ ਹਨ ਇਹ ਗਤੀਵਿਧੀਆਂ ਕਾਰਡੀਓ ਵਰਕਆਊਟ ਹੈ ਜੋ ਦਿਲ ਦੀ ਤੰਦਰੁਸਤੀ ਨੂੰ ਬਿਹਤਰ ਬਣਾਉਂਦਾ ਹੈ ਇਹ ਕੈਲਰੀਜ਼ ਨੂੰ ਤੇਜ਼ੀ ਨਾਲ ਸਾੜਦਾ ਹੈ ਜਿਸ ਕਾਰਨ ਵਜਨ ਘਟਾਉਣ ਲਈ ਬਹੁਤ ਲਾਭਕਾਰੀ ਹੈ ਇਹ ਮਨੋਰੰਜਕ ਅਤੇ ਉਤਸ਼ਾਹ ਭਰਿਆ ਹੁੰਦਾ ਹੈ ਜਿਸ ਨਾਲ ਬੋਰ ਨਹੀਂ ਹੁੰਦਾ ਅਤੇ ਸਰੀਰ ਚੁਸਤ ਚਲਾਕ ਬਣਿਆ ਰਹਿੰਦਾ ਹੈ ਇਸ ਸਰੀਰ ਦੀ ਲਚਕ ਅਤੇ ਮਾਸਪੇਸ਼ੀਆਂ ਦੀ ਸ਼ਕਤੀ ਨੂੰ ਵਧਾਉਣਾ ਹੈ ਇਸ ਸਤਰਕਤਾ ਅਤੇ ਮਨੋਵਿਗਿਆਨਿਕਤਾ ਤੰਦਰੁਸਤੀ ਨੂੰ ਸੁਧਾਰਨ ਸੁਧਾਰਦਾ ਹੈ ਕਿਉਂਕਿ ਇਹ ਹੋਰ ਐਕਸਾਈਜ਼ਾਂ ਤੋਂ ਵਧੇਰੇ ਮਜ਼ੇਦਾਰ ਹੁੰਦੀ ਹੈ ਇਸ ਤਰ੍ਹਾਂ ਅਸੀਂ ਇਸ ਤਰੀਕੇ ਦੀ ਭੰਗੜੇ ਦੀ ਐਰੋਬਿਕਸ ਇੱਕ ਵਿਗਿਆਨਿਕ ਅਤੇ ਮਨੋਰੰਜਕ ਵਿਧੀ ਬਣ ਸਕਦੀ ਹੈ ਜੋ ਹਰ ਉਮਰ ਦੇ ਵਿਅਕਤੀ ਲਈ ਲਾਭਦਾਇਕ ਹੋ ਸਕਦੀ ਹੈ ਅਤੇ ਸਰੀਰ ਨੂੰ ਅਸੀਂ ਬਹੁਤ ਤੰਦਰੁਸਤ ਰੱਖ ਸਕਦੇ ਹਾਂ ਅਸੀਂ ਆਪਣਾ ਇਸ ਨਾਲ ਵੇਟ ਵੀ ਘਟਾ ਸਕਦੇ ਹਾਂ ਜਿਸ ਨਾਲ ਸਾਡੀ ਅੰਦਰੂਨੀ ਸ਼ਕਤੀ ਮਜ਼ਬੂਤ ਰਹਿੰਦੀ ਹੈ